ਜੀ ਨਹੀਂ ਖਾਣਾ ਬਣਾਉਣਾ ਸਿਰਫ ਔਰਤ ਦਾ ਕੰਮ ਨਹੀਂ ਮਰਦ ਵੀ ਬਣਾਉਣ ਤਾਂ ਚਲੋ ਔਰਤ ਦੀ ਕਾਫੀ ਹੈਲਪ ਹੋ ਜਾਂਦੀ ਹੈ ਜਿਵੇਂ ਕਿ ਮੰਨ ਲਓ ਸਾਡੇ ਘਰ ਦੇ ਵਿੱਚ ਹੀ ਆ ਮੈਂ ਬੁਟੀਕ ਦਾ ਕੰਮ ਕਰਦੀ ਹਾਂ ਮੈਨੂੰ ਕਿਸੇ ਵੇਲੇ ਟਾਈਮ ਨਹੀਂ ਲੱਗਦਾ ਅਤੇ ਮੇਰੇ ਹਸਬੈਂਡ ਚਾਹ ਪਰਾਂਠਾ ਈਵਨ ਕਿ ਮੇਰੇ ਨਾਲ ਵਧੀਆ ਬਣਾ ਕੇ ਰਾੜ ਕੇ ਮੇਰੇ ਬੇਟੇ ਨੂੰ ਖਵਾ ਦਿੰਦੇ ਨੇ ਅਤੇ ਇਸ ਤਰੀਕੇ ਨਾਲ ਹੁਣ ਅੱਜ ਕੱਲ੍ਹ ਜੇਕਰ ਅ ਜਿਵੇਂ ਹਰ ਕੋਈ ਫੋਰਨ ਜਾ ਰਿਹਾ ਹੈ ਅਤੇ ਲੋਕ ਜੇ ਅ ਲੜਕੀਆਂ ਨੂੰ ਸਿਖਾ ਰਹੇ ਨੇ ਕਹਿੰਦੇ ਵੀ ਲੜਕੇ ਨੂੰ ਨਹੀਂ ਸਿਖਾਉਣਾ ਲੇਕਿਨ ਮੇਰੇ ਹਿਸਾਬ ਦੇ ਨਾਲ ਲੜਕੇ ਨੂੰ ਵੀ ਸਿਖਾਉਣਾ ਚਾਹੀਦਾ ਹੈ ਤਾਂ ਜੋ ਕੱਲ੍ਹ ਨੂੰ ਉਹ ਬਾਹਰ ਜਾਵੇ ਤਾਂ ਕਿਸੇ ਦੇ ਵ ਹੱਥਾਂ ਵੱਲ ਨਾ ਵੇਖੇ ਆਪਣੇ ਆਪ ਜੇ ਉਹਨੂੰ ਬਣਾਉਣਾ ਹੁੰਦਾ ਤਾਂ ਆਪ ਬਣਾ ਕੇ ਉਹ ਖਾ ਸਕਦਾ ਹੈ ਭੁੱਖਾ ਨਹੀਂ ਰਹਿ ਸਕਦਾ ਮਤਲਬ ਕਿਉਂਕਿ ਜ ਦੇਖੋ ਜੇ ਘਰ ਦੇ ਘਰ ਦੇ ਖਾਣੇ 'ਚ ਅਤੇ ਬਾਹਰ ਦੇ ਖਾਣੇ 'ਚ ਬਹੁਤ ਫਰਕ ਹੁੰਦਾ ਹੈ ਘਰ ਦਾ ਖਾਣਾ ਇੱਕ ਸਿੰਪਲ ਖਾਣਾ ਹੁੰਦਾ ਹੈ ਬਾਹਰ ਦਾ ਖਾਣਾ ਜੇ ਬੱਚਾ ਖਾਂਦਾ ਹੈ ਤਾਂ ਉਹ ਫਿਰ ਬਿਮਾਰ ਹੋਣ ਦੇ ਚਾਂਸਸ ਜ਼ਿਆਦਾ ਹੈ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਮਸਾਲਾ ਪਾਇਆ ਹੁੰਦਾ ਹੈ ਅਤੇ ਇਸ ਤਰੀਕੇ ਨਾਲ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਅ ਈਵਨ ਲੜਕਿਆਂ ਨੂੰ ਵੀ ਜੇ ਖਾਣਾ ਬਣਾਉਣਾ ਸਿਖਾਉਂਦੇ ਨੇ ਤਾਂ ਇਹ ਬਹੁਤ ਹੀ ਚੰਗੀ ਗੱਲ ਹੈ ਕਿ ਬੱਚਾ ਭੁੱਖਾ ਨਹੀਂ ਰਹਿ ਸਕਦਾ ਦੂਸਰਿਆਂ ਨੂੰ ਖਿਲਾ ਸਕਦਾ ਹੈ ਚਲੋ ਓ ਕਈ ਵਾਰੀ ਘਰ ਦੇ ਵਿੱਚ ਕੋਈ ਬਿਮਾਰ ਮਦਰ ਬਿਮਾਰ ਹੋ ਜਾਵੇ ਜਾਂ ਕਿਤੇ ਬਾਹਰ ਚਲੇ ਜਾਵੇ ਤਾਂ ਈਵਨ ਕਿ ਮਦਰਸ ਨੂੰ ਦੁੱਖ ਤਾਂ ਨਹੀਂ ਹੋਵੇਗਾ ਕਿ ਮੇਰਾ ਬੱਚਾ ਭੁੱਖਾ ਹੈ ਉਹਨਾਂ ਨੂੰ ਇਹ ਹੋਵੇਗਾ ਵੀ ਹਾਂ ਜੇ ਅਸੀਂ ਬਾਹਰ ਆਏ ਹਾਂ ਤਾਂ ਮੇਰਾ ਬੱਚਾ ਅਰਮਾਨ ਨਾਲ ਬਣਾ ਕੇ ਖਿਲਾ ਖਾ ਸਕਦਾ ਹੈ ਅਤੇ ਘਰ ਦੇ ਹੋਰ ਮੈਂਬਰਾਂ ਨੂੰ ਵੀ ਖਿਲਾ ਸਕਦਾ ਕਿਉਂਕਿ ਮੇਰੇ ਘਰ ਦੇ ਵਿੱਚ ਇੱਦਾਂ ਹੁੰਦਾ ਹੈ ਮੇਰੇ ਹਸਬੈਂਡ ਖੁਦ ਵੀ ਖਾਂਦੇ ਨੇ ਮੈਂ ਬਾਹਰ ਚਲੀ ਜਾਵਾਂ ਤਾਂ ਬਾਕੀਆਂ ਨੂੰ ਵੀ ਬਣਾ ਕੇ ਖਿਲਾਉਂਦੇ ਨੇ